ਮੈਂ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਇੱਕ ਯਾਤਰਾ ਕੀਤੀ ਸੀ ਆਪਣੀ ਅੱਠਵੀਂ ਕਲਾਸ 'ਚ ਅਤੇ ਉਦੋਂ ਅੱਠਵੀਂ ਕਲਾਸ ਦੀਆਂ ਛੁੱਟੀਆਂ ਹੋਈਆਂ ਹੋਈਆਂ ਸੀ ਅਤੇ ਅਸੀਂ ਸਾਰੇ ਮਤਲਬ ਇੱਕ ਟ੍ਰੇਨ ਦਾ ਪੂਰਾ ਡੱਬਾ ਸਾਡੇ ਪੱਚੀ ਤੀਹ ਫੈਮਿਲੀ ਮੈਂਬਰ ਸੀਗੇ ਰਿਸ਼ਤੇਦਾਰ ਵੀ ਸੀ ਵਿੱਚ ਕੁਛ ਨੋਨ ਸੀਗੇ ਜੋ ਸਾਨੂੰ ਜਾਣਦੇ ਸੀ ਮੇਰੇ ਪਾਪਾ ਦੇ ਫਰੈਂਡ ਸੀਗੇ ਫੈਮਲੀ ਸੀਗੀਆਂ ਉਹਨਾਂ ਦੀਆਂ ਅਤੇ ਮਤਲਬ ਅਸੀਂ ਸਾਰੇ ਹਜੂਰ ਸਾਹਿਬ ਗਏ ਸੀ ਅਤੇ ਉਹ ਮਤਲਬ ਬਹੁਤ ਅੱਛਾ ਐਕਸਪੀਰੀਅੰਸ ਸੀ ਉਹ ਮੈਂ ਹਮੇਸ਼ਾਂ ਯਾਦ ਕਰਦੀ ਹਾਂ ਸਾਰੇ ਆਪਣੇ ਘਰ ਤੋਂ ਮਤਲਬ ਸਰਦੀ ਦਾ ਟਾਈਮ ਸੀ ਉਦੋਂ ਕੁਛ ਨਾ ਕੁਛ ਬਣਾ ਕੇ ਲੈ ਕੇ ਆਏ ਸੀ ਮੇਰੇ ਮੰਮੀ ਪਿੰਨੀਆਂ ਅਤੇ ਕਚੋਰੀਆਂ ਕਾਫੀ ਕੁਛ ਬਣਾ ਕੇ ਲੈ ਕੇ ਗਏ ਸੀ ਅਸੀਂ ਸਾਰੇ ਕੋਈ ਟੋਫੀਜ਼ ਲੈ ਕੇ ਆਇਆ ਸੀ ਕੋਈ ਪਰਾਂਠੇ ਸਾਰਿਆਂ ਨੇ ਮਤਲਬ ਸ਼ੇਅਰ ਕਰਕੇ ਖਾਏ ਦੋ ਦਿਨ ਲੱਗੇ ਸੀ ਸਾਨੂੰ ਤਿੰਨ ਦਿਨ ਉੱਥੇ ਪਹੁੰਚਣ 'ਚ ਉੱਥੇ ਪਹੁੰਚ ਕੇ ਵੀ ਅਸੀਂ ਬਹੁਤ ਇੰਜੋਏ ਕੀਤਾ ਗੁਰਦੁਆਰਾ ਸਭ ਘੁੰਮੇ ਉੱਥੇ ਸਾਰੇ ਅਤੇ ਇਕੱਠੇ ਮਤਲਬ ਉਹ ਟਾਈਮ ਬਹੁਤ ਅੱਛਾ ਸੀਗਾ ਬੈਸਟ ਸੀ ਉਹ ਯਾਤਰਾ ਜੋ ਧਾਰਮਿਕ ਯਾਤਰਾ ਸੀਗੀ ਸਾਡੀ